ਮੇਰੀ ਮਨਪਸੰਦ ਜਿਹੜੀ ਕਿਤਾਬ ਹੈ ਉਹ ਮੈਨੂੰ ਅੱਜ ਤੱਕ ਤਾਂ ਧਰਤੀ ਹੇਠਲਾ ਬਲਦ ਲੱਗੀ ਹੈ ਕਿਉਂਕਿ ਉਹਦੇ ਵਿੱਚ ਜਦੋਂ ਮੈਂ ਉਸ ਕਿਤਾਬ ਨੂੰ ਪੜ੍ਹਿਆ ਸੀ ਜਿਹੜੀ ਉਹਦੀ ਸੱਚਾਈ ਸੀਗੀ ਉਹਦੇ ਤੋਂ ਮੈਂ ਕਾਫੀ ਪ੍ਰਭਾਵਿਤ ਹੋਈ ਜਿਹੜਾ ਵਿਚਲਾ ਉਸਦਾ ਨਾਇਕ ਸੀ ਕਿ ਜਿਵੇਂ ਕਹਾਣੀ ਤਾਂ ਬੜੀ ਲੰਬੀ ਹੈ ਬਟ ਛੋਟੇ ਸ਼ਬਦਾਂ 'ਚ ਹੀ ਕਹਿ ਸਕਦੇ ਹਾਂ ਕਿ ਉਹ ਇੱਕ ਬਜ਼ੁਰਗ ਪਿਤਾ 'ਤੇ ਹੈ ਕਿ ਜਿਹਦਾ ਇੱਕ ਬੱਚਾ ਜਿਹੜਾ ਇਕਲੌਤਾ ਬੇਟਾ ਹੁੰਦਾ ਆ ਉਹ ਫੌਜ 'ਚ ਹੁੰਦਾ ਆ ਅਤੇ ਉਹਦਾ ਜਿਹੜਾ ਦੋਸਤ ਹੈ ਉਹ ਉਹਦੇ ਘਰ ਆਉਂਦਾ ਆ ਅਤੇ ਉਹਦਾ ਪਿਤਾ ਜਿਹੜਾ ਆ ਉਹ ਪਤਾ ਨਹੀਂ ਲੱਗਣ ਦਿੰਦਾ ਉਹਦੀ ਸ਼ਹੀਦੀ ਬਾਰੇ ਕਿ ਜਦੋਂ ਉਹਦਾ ਆਪਣਾ ਬੇਟਾ ਸ਼ਹੀਦ ਹੋ ਜਾਂਦਾ ਹੈ ਅਤੇ ਜਦੋਂ ਉਹਦੇ ਘਰ ਉਹਦਾ ਦੋਸਤ ਆਉਂਦਾ ਹੈ ਤਾਂ ਉਹਨੂੰ ਪਤਾ ਨਹੀਂ ਲੱਗਣ ਦਿੰਦਾ ਕਿ ਉਹਦੀ ਜਿਹੜੀ ਮੌਤ ਹੋ ਚੁੱਕੀ ਹੈ ਜੰਗ 'ਚ ਲੜਦਾ ਲੜਦਾ ਸ਼ਹੀਦ ਹੋ ਚੁੱਕਾ ਹੈ ਅਤੇ ਉਹ ਉਹਦੀ ਹਰ ਤਰ੍ਹਾਂ ਨਾਲ ਪ੍ਰਾਹੁਣਚਾਰੀ ਕਰਦਾ ਆ ਹੱਸਦਾ ਆ ਖੇਡਦਾ ਆ ਪਰ ਉਹ ਇਸ ਕਰਕੇ ਨਹੀਂ ਉਹਨੂੰ ਦੱਸਣਾ ਚਾਹੁੰਦਾ ਕਿਉਂਕਿ ਉਹ ਚਾਹੁੰਦਾ ਨਹੀਂ ਸੀ ਕਿ ਉਹਦਾ ਜਿਹੜਾ ਦੋਸਤ ਹੈ ਮੇਰੇ ਬੱਚੇ ਦਾ ਆਇਆ ਹੈ ਮੇਰੇ ਕੋਲ ਹੱਸਣ ਖੇਡਣ ਵਾਸਤੇ ਉਹਦੀਆਂ ਗੱਲਾਂ ਕਰਨ ਵਾਸਤੇ ਕਿ ਜੇਕਰ ਮੈਂ ਉਹਦੇ ਬਾਰੇ ਦੱਸ ਦੇਵਾਂਗਾ ਤਾਂ ਉਹਦੀ ਜਿਹੜੀ ਛੁੱਟੀ ਹੈ ਉਹ ਅਧੂਰੀ ਰਹਿ ਜਾਵੇਗੀ ਔਰ ਇਸ ਕਹਾਣੀ ਦੇ ਵਿੱਚ ਅੰਤ 'ਤੇ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹਦੇ ਪਿਤਾ ਨੂੰ ਪਤਾ ਸੀਗਾ ਵੀ ਇਸ ਤਰ੍ਹਾਂ ਉਹਦੇ ਬੱਚੇ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਪਰ ਉਹ ਇੰਨੀਆਂ ਪਰੇਸ਼ਾਨੀਆਂ ਦੇ ਵਿੱਚ ਇੰਨੀ ਦੁੱਖ ਦੇ ਵਿੱਚ ਉਹ ਆਪਣੇ ਨਾ ਪਰਿਵਾਰ ਨੂੰ ਦੱਸਦਾ ਆ ਇਹ ਗੱਲ ਅਤੇ ਨਾ ਉਹ ਆਪਣੇ ਜਿਹੜੇ ਆ ਬੇਟੇ ਦੇ ਦੋਸਤ ਨੂੰ ਦੱਸਦਾ ਆ ਸੋ ਉਹਨੂੰ ਇੱਕ ਕਹਾਣੀਕਾਰ ਨੇ ਜਿਹੜੀ ਉਹਦੀ ਸੱਚਾਈ ਆ ਉਹ ਧਰਤੀ ਹੇਠਲਾ ਬਲਦ ਕਹਿ ਕੇ ਸੰਬੋਧਿਤ ਕੀਤੀ ਹੈ ਕਿ ਜਿਵੇਂ ਧਰਤੀ ਹੇ ਜਿਹੜਾ ਬਲਦ ਹੈ ਧਰਤੀ ਹੇਠਾਂ ਉਹ ਆਪਣਾ ਸਾਰਾ ਬੋਝ ਧਰਤੀ ਦਾ ਆਪਣੇ ਸਿੰਗਾਂ 'ਤੇ ਚੁੱਕੀ ਫਿਰਦਾ ਹੈ ਅਤੇ ਇਸ ਤਰ੍ਹਾਂ ਉਹ ਜਿਹੜਾ ਬਜ਼ੁਰਗ ਸੀਗਾ ਉਹ ਵੀ ਉਹਨੂੰ ਜਿਹੜਾ ਧਰਤੀ ਹੇਠਲਾ ਬਲਦ ਹੀ ਲੱਗਾ ਸੋ ਇਹ ਕਹਾਣੀ ਜਿਹੜੀ ਹੈ ਉਹ ਬਹੁਤ ਹੀ ਮਤਲਬ ਕਿ ਉਦਾਸ ਕਰਨ ਵਾਲੀ ਸੀ ਅਤੇ ਉਹ ਤੋਂ ਪ੍ਰੇਰਨਾ ਲੈਣ ਦੀ ਵੀ ਲੋੜ ਸੀਗੀ ਕਿ ਜਿੰਨਾ ਮਰਜ਼ੀ ਜੀਵਨ ਦੇ ਵਿੱਚ ਦੁੱਖ ਆਵੇ ਅਤੇ ਸੋ ਆਪਾਂ ਨੂੰ ਆਪਣਾ ਜਿਹੜਾ ਉਤਸ਼ਾਹ ਜਿਹੜਾ ਆ ਉਹ ਜਾਂ ਉਹ ਸਹਿਣਸ਼ੀਲਤਾ ਆ ਉਹ ਬਣਾਈ ਰੱਖਣੀ ਚਾਹੀਦੀ ਹੈ ਧੰਨਵਾਦ